ਪਹਿਲਾਂ ਹੀ ਉਸ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਵੇ ਅਤੇ ਉਸ ਦੇ ਡੱਸੇ ਹੋਏ ਅੰਗ ਦੇ ਉੱਤੇ ਇੱਕ ਜ਼ੋਰ ਕੇ ਕੱਪੜਾ ਬੰਨ੍ਹ ਦਿੱਤਾ ਜਾਵੇ ਜਿਸ ਕਾਰਨ ਜ਼ਹਿਰ ਉਸਦੇ ਹੋਰ ਅੰਗਾਂ ਵਿੱਚ ਜਾਣ ਤੋਂ ਰੁਕ ਸਕੇਗਾ ਉਸ ਤੋਂ ਬਾਅਦ ਉਸ ਨੂੰ ਉ ਉਸਦੇ ਡੱਸੇ ਹੋਏ ਥਾਂ ਨੂੰ ਪਾਣੀ ਨਾਲ ਧੋ ਦਿੱਤਾ ਜਾਵੇ ਅਤੇ ਉਸ ਵਿੱਚੋਂ ਜ਼ਹਿਰ ਕੱਢਣ ਦਾ ਕੋਈ ਪ੍ਰਬੰਧ ਕਰ ਦਿੱਤਾ ਜਾਵੇ ਬਾਅਦ ਵਿੱਚ ਇੱਕ ਸੌ ਅੱਠ ਨੰਬਰ 'ਤੇ ਫੋਨ ਕਰਕੇ ਡ ਡਾਕਟਰੀ ਸਹਾਇਤਾ ਮੰਗਵਾ ਦਿੱਤੀ ਜਾਵੇ ਅਤੇ ਉਸਨੂੰ ਪ੍ਰਾਈਵੇਟ ਹਸਤਪਾਲ ਵਿੱਚ ਲੈ ਕੇ ਜਾਣ ਦੀ ਥਾਂ ਉਸਨੂੰ ਸਰਕਾਰੀ ਹਸਪਤਾਲ ਵਿੱਚ ਹੀ ਲਿਜਾਇਆ ਜਾਵੇ ਇਸ ਨਾਲ ਅਸੀਂ ਉਸਦੀ ਜਾਨ ਬਚਾ ਸਕਦੇ ਹਾਂ